ਇੱਕ ਵਾਰ ਦੀ ਗੱਲ ਆ ਕਿ ਵਿੰਟਰ ਫੈਸਟੀਵਲ ਚੱਲ ਰਿਹਾ ਸੀ ਜਿਸ ਕਰਕੇ ਔਨਲਾਈਨ ਸੇਲ ਲੱਗੀ ਹੋਈ ਸੀ ਅਤੇ ਪ੍ਰੋਡਕਟ ਸਾਰੀਆਂ ਚਲੋ ਚੀਜ਼ਾਂ ਦਾ ਬਹੁਤ ਰੇਟ ਡਾਊਨ ਹੋ ਰਹੇ ਸੀ ਅਤੇ ਮੈਂ ਵੀ ਵਿਚਾਰ ਬਣਾਇਆ ਵੀ ਮੈਂ ਵੀ ਕੁਛ ਖਰੀਦ ਲਵਾਂ ਦੇਖਦੇ ਦੇਖਦੇ ਚਲੋ ਮੈਂ ਕੱਪੜੇ ਵਾਲਾ ਕੱਢਿਆ ਅਤੇ ਉੱਥੇ ਮੈਨੂੰ ਇੱਕ ਜੈਕਿਟ ਪਸੰਦ ਆ ਗਈ ਉਹ ਵੂਲਨ ਵਾਲੀ ਅਤੇ ਮੈਂ ਫਿਰ ਉਹ ਦੇਖੀ ਉਹ ਰਿਵਿਊ ਵੀ ਦੇਖੇ ਉਹਦੇ ਬੜੇ ਸੋਹਣੇ ਸੀ ਪਰ ਉਹ ਸਾਈਟ ਨਹੀਂ ਸੀ ਸਹੀ ਜਿੱਥੋਂ ਮੈਂ ਮੰਗਵਾ ਰਿਹਾ ਸੀ ਪਰ ਚਲੋ ਮਾੜੇ ਟਾਈਮ ਦਾ ਕਿਹੜਾ ਪਤਾ ਹੁੰਦਾ ਏ ਅਤੇ ਮੈਂ ਉਹ ਮੰਗਵਾਈ ਮੈਂ ਬਹੁਤ ਖੁਸ਼ ਸੀ ਵੀ ਹਾਂ ਜੈਕਿਟ ਮਿਲ ਗਈ ਘੱਟ ਰੇਟ 'ਚ ਚਲੋ ਮੈਨੂੰ ਫੋਨ ਆਇਆ ਉਹਨਾਂ ਦਾ ਮੈਂ ਫੜਨ ਗਿਆ ਉੱਚੇ ਪਿੰਡ ਤੋਂ ਬੜੀ ਖੁਸ਼ੀ ਖੁਸ਼ੀ ਗਿਆ ਬੜੀ ਖੁਸ਼ੀ ਖੁਸ਼ੀ ਆਇਆ ਜਦੋਂ ਘਰ ਆ ਕੇ ਮੈਂ ਉਹ ਖੋਲ੍ਹਿਆ ਮੈਨੂੰ ਉਦੋਂ ਹੀ ਸ਼ੱਕ ਜਿਹਾ ਪਿਆ ਵੀ ਐਡੀ ਬੜੀ ਜੈਕਿਟ ਇੰਨੇ ਛੋਟੇ ਪੈਕਟ 'ਚ ਕਿਵੇਂ ਚਲੋ ਹੁਣ ਜਦੋਂ ਖੋਲ੍ਹਿਆ ਜਦੋਂ ਕੱਢੀਆਂ ਤਾਂ ਉਹਦੇ ਵਿੱਚ ਚਾਰ ਜਰਾਬਾਂ ਦੇ ਜੋੜੇ ਜਿਸ ਕਰਕੇ ਮੇਰਾ ਬਹੁਤ ਘਟੀਆ ਐਕਸਪੀਰੀਅੰਸ ਰਿਹਾ ਅਤੇ ਮੈਂ ਹੁਣ ਔਨਲਾਈਨ ਚੀਜ਼ਾਂ ਤੋਂ ਵੋਆਇਡ ਕਰਦਾ ਏ ਬਹੁਤ